ਟੈਕਨੋਲਜੀ ਅੱਜ ਦੇ ਸੰਸਾਰ ਵਿੱਚ ਹਰ ਜਗ੍ਹਾ ਹੈ ਇਹ ਪ੍ਰਭਾਵਿਤ ਕਰਦਾ ਹੈ ਕੀ ਅਸੀਂ ਇਸਦਾ ਕਿਵੇਂ ਸੰਚਾਰ ਕਰਦੇ ਹਾਂ ਸਿੱਖਦੇ ਹਾਂ ਕੰਮ ਕਰਦੇ ਹਾਂ ਖੇਡਦੇ ਹਾਂ ਅਤੇ ਸੋਚਦੇ ਹਾਂ ਟੈਕਨਾਲੋਜੀ ਸਾਡੇ ਜ਼ਿੰਦਗੀ ਨੂੰ ਆਸਾਨ ਤੇਜ਼ ਅਤੇ ਹੋਰ ਮਜ਼ੇਦਾਰ ਬਣਾ ਸਕਦੀ ਹੈ ਪਰ ਇਹ ਨਵੇ ਜੋਤ ਚੁਣੌਤੀਆਂ ਜ਼ੋਖਮਾ ਅਤੇ ਨੈਤਿਕ ਦੁਬਿਧਾਵਾਂ ਵੀ ਪੈਦਾ ਕਰ ਸਕਦੀ ਹੈ ਤੈਕਨਾਲੋਜੀ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਸਾਡੀ ਮਦਦ ਵੀ ਕਰ ਸਕਦੀ ਹੈ ਪਰ ਇਹ ਨਵੀਆਂ ਬਣਾ ਵੀ ਸਕਦੀ ਹੈ ਟੈਕਨਾਲੋਜੀ ਸਾਨੂੰ ਵੱਖ ਵੱਖ ਸੱਭਿਆਚਾਰਾਂ ਅਤੇ ਪਿਛੋਕੜਾਂ ਦੇ ਲੋਕਾਂ ਨਾਲ ਜੋੜ ਸਕਦੀ ਹੈ ਪਰ ਇਹ ਸਾਨੂੰ ਸਾਡੇ ਭਾਈਚਾਰਿਆਂ ਅਤੇ ਪਰਿਵਾਰਾਂ ਤੋਂ ਵੀ ਅਲੱਗ ਕਰ ਸਕਦੀ ਹੈ ਟੈਕਨਾਲੋਜੀ ਸਾਨੂੰ ਆਪਣੇ ਆਪ ਪ੍ਰਗਟ ਅਤੇ ਆਪਣੇ ਆਪ ਜਨੂੰਨ ਨੂੰ ਵਧਾਉਣ ਲਈ ਸ਼ਕਤੀ ਵੀ ਪ੍ਰਦਾਨ ਕਰ ਸਕਦੀ ਹੈ ਟੈਕਨਾਲੋਜੀ ਅੱਜ ਦੇ ਸੰਸਾਰ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਪਰ ਇਹ ਸਿਰਫ ਮਹੱਤਵਪੂਰਨ ਚੀਜ਼ ਨਹੀਂ ਸਾਨੂੰ ਟੈਕਨੋਲੋਜੀ ਦੇ ਫਾਇਦਿਆਂ ਕਮੀਆਂ ਤੋਂ ਜਾਣੂ ਹੋਣ ਦੀ ਵੀ ਲੋੜ ਹੈ ਅਤੇ ਇਸ ਨੂੰ ਸਮਝਦਾਰੀ ਅਤੇ ਜ਼ਿੰਮੇਵਾਰੀ ਨਾਲ ਵਰਤਣ ਦੀ ਵੀ ਲੋੜ ਹੈ ਸਾਨੂੰ ਸਾਡੇ ਜੀਵਨ ਦੇ ਹੋਰ ਪਹਿਲੂਆਂ ਜਿਵੇਂ ਕਿ ਸਰੀਰਿਕ ਸਿਹਤ ਮਾਨਸਿਕ ਤੰਦਰੁਸਤੀ ਸਮਾਜਿਕ ਰਿਸ਼ਤੇ ਅਤੇ ਨਿੱਜੀ ਵਿਕਾਸ ਨਾਲ ਟੈਕਨੋਲੋਜੀ ਦੇ ਸਾਡੀ ਵਰਤੋਂ ਨੂੰ ਸੰਤੁਲਿਤ ਕਰਨ ਦੀ ਲੋੜ ਹੈ ਸਾਨੂੰ ਇਸ ਦੀ ਸਿਰਜਨਾਤਮਕ ਅਤੇ ਚਿੰਤਕ ਫੈਸਲੇ ਲੈ ਸਕਦੇ ਹਨ ਅਤੇ ਬਦਲੀਆਂ ਸਥਿਤੀਆਂ ਨੂੰ ਅਨੁਕੂਲ ਹੋ ਵੀ ਸਕਦੇ ਹਨ ਧੰਨਵਾਦ